ਹੈਲੋ ਸਤਿ ਸ਼੍ਰੀ ਅਕਾਲ ਜੀ ਮੱਖਣ ਸਿੰਘ ਗੱਲ ਗੱਲ ਕਰਦੇ ਬਾਬਾ ਜੀ ਮੈਨੇਜਰ ਜੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਤੋਂ ਜੀ ਹਾਂਜੀ ਬਾਬਾ ਜੀ ਬਾਬਾ ਜੀ ਅਸੀਂ ਬਾਹਰੋਂ ਹੀ ਹਾਂ ਅਸੀਂ ਪਾਠ ਕਰਵਾਉਣਾ ਸੀ ਇੱਥੇ ਗੁਰਦੁਆਰਾ ਸਾਹਿਬ ਬਾਬਾ ਜੀ ਅਤੇ ਸਾਨੂੰ ਇੱਥੇ ਤੁਸੀਂ ਦੱਸ ਸਕਦੇ ਹੋ ਥੋੜ੍ਹਾ ਬਹੁਤਾ ਜੀ ਕਿੱਦਾਂ ਇੱਥੇ ਦਾ ਅਰੇਜਮੈਂਟ ਜੀ ਭੇਟਾਂ ਭੇਟਾਂ ਬਾਰੇ ਦੱਸ ਸਕਦੇ ਹੋ ਜੀ ਅਸੀਂ ਅਸੀਂ ਲੰਗ ਲੰਗਰ ਵੀ ਕਰਵਾਉਣਾ ਬਾਬਾ ਜੀ ਉਹਦੇ ਬਾਰੇ ਵੀ ਦੱਸ ਦਿਉ ਹਾਂਜੀ ਬਾਬਾ ਜੀ ਅੱਛਾ ਬਾਬਾ ਜੀ ਠੀਕ ਆ ਬਾਬਾ ਜੀ ਠੀਕ ਆ ਬਾਬਾ ਜੀ ਠੀਕ ਠੀਕ ਆ ਬਾਬਾ ਜੀ ਅਤੇ ਇੱਥੇ ਜੀ ਆਪਣਾ ਅਸੀਂ ਅਖੰਡ ਸਹਿਜ ਪਾਠ ਵੀ ਜੀ ਹੁੰਦੇ ਹੈ ਜੀ ਹੈ ਨਾ ਜੀ ਠੀਕ ਆ ਬਾਬਾ ਜੀ ਅਤੇ ਤਰੀਕ ਸਾਨੂੰ ਕਦੋਂ ਦੀ ਮਿਲ ਸਕਦੀ ਹੈ ਜੀ ਅਤੇ ਬਾਬਾ ਜੀ ਇਹ ਸਾਨੂੰ ਕੁਛ ਦਿਨ ਪਹਿਲਾਂ ਬੁੱਕ ਕਰਵਾਉਣੀ ਪਊਗੀ ਜਾਂ ਸਿੱਧਾ ਡਾਇਰੈਕਟ ਹੀ ਮਿਲ ਜੂਗੀ ਠੀਕ ਆ ਬਾਬਾ ਜੀ ਠੀਕ ਹੈ ਬਾਬਾ ਓਕੇ ਜੀ ਬਾਬਾ ਜੀ ਅਸੀਂ ਇੱਕ ਵਾਰ ਤੁਹਾਡੇ ਨਾਲ ਆ ਕੇ ਵੀ ਗੱਲ ਕਰ ਲਵਾਂਗੇ ਜੀ ਠੀਕ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ